ਭੰਗੜਾ ਸਾਡਾ ਮਨੋਰੰਜਨ ਦਾ ਇਕ ਬਹੁਤ ਹੀ ਵਧੀਆ ਸਾਧਨ ਹੈ ਅਸੀਂ ਭੰਗੜਾ ਆਪਣੇ ਖੁਸ਼ੀ ਦੇ ਮੌਕੇ 'ਤੇ ਪਾਉਂਦੇ ਹਾਂ ਜਦੋਂ ਵੀ ਕੋਈ ਜਨਮ ਹੁੰਦਾ ਹੈ ਬੱਚੇ ਦਾ ਜਾਂ ਅ ਕਿਸਾਨ ਆਪਣੀਆਂ ਫ਼ਸਲਾਂ ਦੀ ਵਾਢੀ ਕਰਦੇ ਹਨ ਤਾਂ ਉਹ ਆਪਣੀ ਖੁਸ਼ੀ ਦੇ ਵਿੱਚ ਭੰਗੜੇ ਨੂੰ ਪਾਉਂਦੇ ਹਨ ਭੰਗੜੇ ਦਾ ਸਨ ਸਾਡਾ ਮਨੋਰੰਜਨ ਦਾ ਸਾਧਨ ਹੈ ਪਰ ਕੁਛ ਲੋਕਾਂ ਦੀਆਂ ਧਾਰਨਾਵਾਂ ਹਨ ਕਿ ਭੰਗੜਾ ਪਾਉਣਾ ਗਲਤ ਹੈ ਭੰਗੜਾ ਗਲਤ ਨਹੀਂ ਹੈ ਭੰਗੜਾ ਸਾਰੇ ਨੂੰ ਚੰਗਾ ਲੱਗਦਾ ਹੈ ਭੰਗੜੇ ਅੱਜ ਕੱਲ੍ਹ ਤਾਂ ਅੰਗਰੇਜ਼ ਵੀ ਭੰਗੜਾ ਪਾਉਣ ਪਾਉਣਾ ਪਸੰਦ ਕਰਦੇ ਹਨ ਪਰ ਜੇਕਰ ਇਹਨਾਂ ਦਾ ਕੁਛ ਦਾ ਧਾਰਨਾਵਾਂ ਹਨ ਕਿ ਭੰਗੜੇ ਦਾ ਡੋਲ ਦਾ ਢਗੇ ਡਗੇ ਦੀ ਆਵਾਜ਼ ਬਹੁਤ ਆਉਂਦੀ ਹੈ ਜੋ ਕਿ ਸਿਰ ਪੀੜ ਹੋਣ ਲੱਗ ਜਾਂਦੀ ਹੈ ਪਰ ਉਹਨਾਂ ਦੇ ਨੂੰ ਇਹ ਨਹੀਂ ਪਤਾ ਕਿ ਇਹ ਸਾਨੂੰ ਮਨੋਰੰਜਨ ਕਰਦੇ ਹਨ ਅਤੇ ਇਹਨਾਂ ਦਾ ਭੰਗੜਾ ਪਾਉਣਾ ਬਹੁਤ ਹੀ ਚੰਗਾ ਅਤੇ ਅੱਛਾ ਹੈ ਉਹ ਲੋਕਾਂ ਦੀਆਂ ਧਾਰਨਾਵਾਂ ਗਲਤ ਹਨ ਕਿ ਭੰਗੜਾ ਭੰਗੜਾ ਠੀਕ ਨਹੀਂ ਹੈ ਭੰਗੜਾ ਸਾਡਾ ਲੋਕ ਨਾਚ ਹੈ ਭੰਗੜਾ ਪਾਉਣਾ ਬਹੁਤ ਹੀ ਚੰਗਾ ਹੈ ਅਸੀਂ ਆਪਣੇ ਹਰੇਕ ਖੁਸ਼ੀ 'ਤੇ ਮੌਕੇ 'ਤੇ ਭੰਗੜਾ ਪਾਉਂਦੇ ਹਾਂ